ਹਾਂ ਇਹ ਤਾਂ ਵਧੀਆ ਹੈ ਕਿ ਬਿਲਕੁਲ ਸਹੀ ਗੱਲ ਹੈ ਕਿ ਇੱਕ ਵਧੀਆ ਫੋਟੋ ਖਿੱਚਣ ਲਈ ਤਾਂ ਰੋਸ਼ਨੀ ਦੀ ਬਹੁਤ ਜ਼ਿਆਦੀ ਜ਼ਰੂਰਤ ਹੈ ਉਹ ਬੰਦਾ ਜਿੰਨਾ ਵੀ ਮਰਜ਼ੀ ਸੋਹਣਾ ਅੱਛੇ ਤਰੀਕੇ ਨਾ ਤਿਆਰ ਹੋਇਆ ਹੋਵੇ ਜੇ ਰੋਸ਼ਨੀ ਨਾ ਹੋਵੇ ਅਤੇ ਜਿੱਥੇ ਰੋਸ਼ਨੀ ਦੀ ਕਮੀ ਹੋਵੇ ਉੱਥੇ ਫੋਟੋ ਨਹੀਂ ਸਹੀ ਆਉਂਦੀ ਜਿਸ ਤਰ੍ਹਾਂ ਦੇਖੋ ਹੁਣ ਬਾਹਰ ਤੁਸੀਂ ਸੂਰਜ ਦੀ ਰੋਸ਼ਨੀ ਵਿੱਚ ਫੋਟੋ ਖਿੱਚ ਲਓ ਉੱਥੇ ਬਹੁਤ ਵਧੀਆ ਫੋਟੋ ਆਏਗੀ ਤੁਹਾਡੀ ਜੇ ਜੇ ਤੁਸੀਂ ਅੰਧੇਰੇ ਵਿੱਚ ਜਿੰਨ੍ਹਾਂ ਮਰਜੀ ਤੁਸੀਂ ਤਿਆਰ ਹੋ ਲਓ ਜੇ ਅੰਧੇਰੇ ਵਿੱਚ ਖੜ ਕੇ ਫੋਟੋ ਖਿਚਵਾਓਗੇ ਨਹੀਂ ਅੱਛੀ ਆਵੇਗੀ ਇਸ ਕਰਕੇ ਅੱਜ ਕੱਲ੍ਹ ਤਾਂ ਹੁਣ ਅਲੱਗ ਅਲੱਗ ਤਰ੍ਹਾਂ ਦੀਆਂ ਰੋਸ਼ਨੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਲਾਈਟਾਂ ਅਗਾਂਹ ਲਗਾ ਦਿੰਦੇ ਆ ਫੋਟੋ ਖਿੱਚਣ ਲਈ ਅਤੇ ਫੋਟੋਆਂ ਬਸ ਉਸ ਤਰੀਕੇ ਨਾਲ ਵਧੀਆ ਆ ਜਾਂਦੀਆਂ ਇਸ ਲਈ ਕਈ ਲੋਕ ਅੰਦਰੋਂ ਹੀ ਫੋਟੋਆਂ ਖਿੱਚ ਲੈਂਦੇ ਅਲੱਗ ਅਲੱਗ ਤਰ੍ਹਾਂ ਦੀਆਂ ਲਾਈਟਾਂ ਜਗਾ ਕੇ ਅਤੇ ਫੋਟੋ ਦਾ ਆਪਣਾ ਉਹ ਮੂਡ ਤਾਂ ਆਪੇ ਬਣ ਜਾਂਦਾ ਜੇ ਫੋਟੋ ਵਧੀਆ ਆ ਜਾਵੇ ਤਾਂ ਮੂਡ ਵਧੀਆ ਆ ਹੋ ਜਾਂਦਾ ਜੇ ਨਾ ਫੋਟੋ ਵਧੀਆ ਆਵੇ ਤੁਸੀਂ ਭਵਾਂ ਜਿੰਨਾ ਮਰਜ਼ੀ ਉਹ ਹੋਵੇ ਤਾਂ ਬੰਦੇ ਦਾ ਮੂਡ ਖ਼ਰਾਬ ਹੋ ਜਾਂਦਾ ਕਿ ਸਾਡੀ ਫੋਟੋ ਨਹੀਂ ਅੱਛੀ ਆਈ ਇਸ ਲਈ ਫੋਟੋ ਵਧੀਆ ਅਤੇ ਮੂਡ ਵਧੀਆ ਬਣਾ ਫੋਟੋ ਵਧੀਆ ਬਣਾਉਣ ਲਈ ਖਿੱਚਣ ਲਈ ਤਾਂ ਰੋਸ਼ਨੀ ਦੀ ਬਹੁਤ ਜ਼ਰੂਰਤ ਹੈ ਅੰਧੇਰੇ ਵਿੱਚ ਤਾਂ ਫੋਟੋ ਆਉਣੀ ਹੀ ਨਹੀਂ ਹੈਗੀ ਅੱਛੀ ਇਸ ਲਈ ਰੋਸ਼ਨੀ ਦੀ ਬਹੁਤ ਜ਼ਰੂਰਤ ਹੈ ਫੋਟੋ ਖਿੱਚਣ ਲਈ ਧੰਨਵਾਦ